ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਨੂੰ ਮੇਰੇ ਬੇਟੇ ਨੇ ਦੱਸਿਆ ਕਿ ਮੰਮੀ ਅੱਜ ਕੱਲ ਔਨਲਾਈਨ ਸੌਂਪਿੰਗ ਵਿੱਚ ਹਰ ਇੱਕ ਚੀਜ਼ ਨੂੰ ਮੰਗਵਾਇਆ ਜਾ ਸਕਦਾ ਹੈ ਤਾਂ ਮੇਰਾ ਮਨ ਕੀਤਾ ਅਤੇ ਮੈਂ ਪਹਿਲਾਂ ਕਈ ਤਰ੍ਹਾਂ ਦਾ ਸਮਾਨ ਮੰਗਵਾਇਆ ਸੀ ਪਰ ਹੁਣ ਮੈਂ ਇੱਕ ਚੱਪਲ ਆਡਰ ਕੀਤ ਕਰ ਦਿੱਤੀ ਜਦੋਂ ਉਹ ਚੱਪਲ ਕੁਝ ਦਿਨ ਬਾਅਦ ਮੇਰੇ ਕੋਲ ਪਹੁੰਚੀ ਤਾਂ ਮੈਨੂੰ ਮੈਂ ਉਸ ਨੂੰ ਬਕਸੇ ਵਿੱਚੋਂ ਕੱਢਿਆ ਅਤੇ ਉਹ ਚੱਪਲ ਬਿਲਕੁਲ ਵੀ ਮੈਨੂੰ ਚੰਗੀ ਨਾ ਲੱਗੀ ਕਿਉਂਕਿ ਇਹ ਇੱਕ ਤਾਂ ਮੇਰਾ ਮੈਂ ਜਿਹੜਾ ਕਲਰ ਮੰਗਵਾਇਆ ਸੀ ਉਹ ਕਲਰ ਨਹੀਂ ਸੀ ਮੈਂ ਉਸ ਚੱਪਲ ਨੂੰ ਦੇਖਿਆ ਅਤੇ ਜਦੋਂ ਮੈਂ ਦੇਖਿਆ ਮੈਨੂੰ ਬਿਲਕੁਲ ਵੀ ਮੰਦ ਬੜਾ ਹੀ ਮੰਦਾ ਲੱਗਿਆ ਕਿਉਂਕਿ ਕੰਪਨੀ ਨੇ ਮੈਨੂੰ ਉਹ ਚੱਪਲ ਬੜੀ ਮਾੜੀ ਦਿੱਤੀ ਇੱਕ ਘਟੀਆ ਚੱਪਲ ਭੇਜ ਦਿੱਤੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੰਪਨੀ ਨੂੰ ਚਾਹੀਦਾ ਹੈ ਕਿ ਜੋ ਸਮਾਨ ਮੰਗਵਾਇਆ ਜਾਵੇ ਉਸ ਸਮਾਨ ਨੂੰ ਹੀ ਭੇਜਿਆ ਜਾਵੇ ਨਹੀਂ ਤਾਂ ਕਈ ਤਰ੍ਹਾਂ ਦੇ ਗ੍ਰਾਹਕ ਪ੍ਰੇਸ਼ਾਨ ਹੁੰਦੇ ਹਨ ਮੈਨੂੰ ਮੇਰੀ ਸਹੇਲੀ ਨੇ ਦੱਸਿਆ ਕਿ ਜੇਕਰ ਤੂੰ ਇਹ ਸਮਾਨ ਮੰਗਵਾਇਆ ਹੈ ਤਾਂ ਤੈਨੂੰ ਪਸੰਦ ਨਹੀਂ ਆਇਆ ਤਾਂ ਉਸ ਨੂੰ ਵਾਪਸ ਵੀ ਕਰ ਸਕਦੀ ਹਾਂ ਪਰ ਮੈਂ ਵਾਪਸ ਕਰਨ ਦੀ ਚੇਸਟਾ ਨਹੀਂ ਕੀਤੀ ਪਰ ਮੇਰੇ ਮਨ ਨੂੰ ਵਾਰ ਵਾਰ ਪਰੇਸ਼ਾਨੀ ਦਾ ਸਾਹਮਣਾ ਕਰ ਕਰਨਾ ਪੈਂਦਾ ਹੈ ਕਿ ਇਹ ਚੱਪਲ ਚੰਗੀ ਨਹੀਂ ਸੀ ਅਤੇ ਮੈਂ ਇਸ ਨੂੰ ਦੇਖਦੀ ਅਤੇ ਉਦਾਸ ਹੋ ਜਾਂਦੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਸਦਾ ਹੀ ਉਹ ਚੀਜ਼ਾਂ ਦੀ ਜ਼ਰੂਰਤ ਚਾਹੀਦੀ ਹੈ ਜੋ ਚੀਜ਼ਾਂ ਮੰਗਵਾਈਆਂ ਜਾਣ ਉਸ ਨੂੰ ਸਹੀ ਹੀ ਭੇਜੀਆਂ ਜਾਵੇ ਅਤੇ ਮੈਂ ਇੱਕ ਵਾਰ ਫਿਰ ਕੰਪਨੀ ਨੂੰ ਇਹ ਮੰਗ ਕਰਦੀ ਹਾਂ ਕਿ ਬੜੀ ਦੇਖ ਰੇਖ ਦੇ ਸਮਾਨ ਭੇਜਿਆ ਜਾਵੇ ਤਾਂ ਕਿ ਗ੍ਰਾਹਕ ਪਰੇਸ਼ਾਨ ਨਾ ਹੋਣ ਧੰਨਵਾਦ